ਮੇਰੇ ਕੋਲ ਇੱਕ ਗੱਡੀ ਹੈ ਜੋ ਕਿ ਪੰਦਰ੍ਹਾਂ ਸਾਲ ਤੋਂ ਹੁਣ ਉਮਰ ਉਹਦੀ ਪੰਦਰ੍ਹਾਂ ਸਾਲ ਤੋਂ ਵੱਧ ਗਈ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਉਹ ਗੱਡੀ ਪੰਦਰ੍ਹਾਂ ਸਾਲ ਤੋਂ ਬਾਅਦ ਪੰਜ ਸਾਲ ਦੇ ਲਈ ਹੋਰ ਚਲਾਵਾਂ ਤਾਂ ਉਸ ਲਈ ਮੈਨੂੰ ਸਰਟੀਫਿਕੇਟ ਚਾਹੀਦਾ ਕਿ ਤੰਦਰੁਸਤੀ ਦਾ ਸਰਟੀਫਿਕੇਟ ਚਾਹੀਦਾ ਹੈ ਉਸ ਤੰਦਰੁਸਤੀ ਸਰਟੀਫਿਕੇਟ ਓਨਲਾਈਨ ਵੀ ਮਿਲ ਜਾਂਦਾ ਹੈ ਪਰ ਉਹ ਓਨਲਾਈਨ ਦੀ ਪ੍ਰਕਿਰਿਆ ਕੀ ਬਣਦੀ ਹੈ ਉਹ ਉਹਦਾ ਕੁਛ ਪਤਾ ਨਹੀਂ ਹੈ ਤਾਂ ਕਰਕੇ ਮੈਂ ਇਹ ਦਾ ਪੁੱਛ ਰਿਹਾਂ ਕਿ ਕਿੱਦਾਂ ਅਸੀਂ ਕਰ ਸਕਦੇ ਹਾਂ ਜਿੱਦਾਂ ਮੈਂ ਓਨਲਾਈਨ ਪਰਿਵਾਹਨ ਡੋਟ ਕੋਮ 'ਤੇ ਜਾ ਕੇ ਆਪਣੀ ਰਜਿਸਟਰ ਕਾਰ ਨੂੰ ਲਿੰਕ ਭੇਜ ਦਿੱਤੀਆਂ ਲਿੰਕ 'ਤੇ ਕਰਕੇ ਪੰਜਾਬ ਦੇ ਵਿੱਚ ਅਤੇ ਉਹਨੂੰ ਸੈਂਡ ਤਾਂ ਕਰ ਦਿੱਤਾ ਹੈ ਬਟ ਉਹ ਕਹਿ ਰਿਹਾ ਹੈ ਕਿ ਮੈਨੂੰ ਸੁਵੀਧਾ ਕੇਂਦਰ ਜਾ ਕੇ ਡਾਕੂਮੈਂਟ ਦੁਬਾਰਾ ਸਬਮਿਟ ਕਰਵਾਉਣੇ ਪੈਣੇ ਹੈ ਅਤੇ ਉੱਥੇ ਸਬਮਿਟ ਕਰਵਾਉਣ ਤੋਂ ਬਾਅਦ ਕਿਆ ਮੈਨੂੰ ਆਪਣੀ ਗੱਡੀ ਹੀ ਗੱਡੀ 'ਤੇ ਹੀ ਆਉਣਾ ਪਵੇਗਾ ਕਿ ਕਿਸੀ ਵੀ ਗੱਡੀ 'ਤੇ ਆ ਸਕਦੇ ਹੈ ਜੇ ਚੈਕਿੰਗ ਮੇਰੀ ਗੱਡੀ ਦੀ ਉੱਥੇ ਹੋਜੂਗੀ ਕਿ ਕਿਸੇ ਹੋਰ ਪ੍ਰਾਈਵੇਟ ਵੈਂਡਰ ਕੋਲ ਜਾ ਕੇ ਜਾਣਾ ਇਹ ਸਾਰੇ ਜੋ ਕਓਸ਼ਨਸ ਹੈਗੇ ਹੈ ਉਹਦਾ ਜਵਾਬ ਥੋੜ੍ਹਾ ਜਿਹਾ ਔਖਾ ਮਿਲਦਾ ਹੈ